ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਕੰਪਨੀ ਤੋਂ ਇੱਕ ਗੱਡੀ ਬੁੱਕ ਕਰਵਾਈ ਸੀਗੀ ਅਤੇ ਡਰਾਈਵਰ ਟਾਈਮ 'ਤੇ ਨਹੀਂ ਗੱਡੀ ਲੈ ਕੇ ਪਹੁੰਚਿਆ ਜਿਸ ਨਾਲ ਮੈਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਮੈਂ ਜਲਦੀ ਜਾਣਾ ਸੀਗਾ ਮੇਰਾ ਜ਼ਰੂਰੀ ਸੀਗਾ ਜਾਣਾ ਅਤੇ ਹੁਣ ਮੈਨੂੰ ਨਾ ਤਾਂ ਇਸ ਟਾਈਮ ਕੋਈ ਮਿਲ ਰਿਹਾ ਹੈ ਇਸ ਕਰਕੇ ਮੈਨੂੰ ਹੁਣ ਕੋਈ ਵੀ ਹਿੱਲਾ ਕਰਕੇ ਦਿੱਤਾ ਜਾਵੇ ਤਾਂ ਜੋ ਮੈਂ ਉੱਥੇ ਟਾਈਮ ਨਾਲ ਪਹੁੰਚ ਸਕਾਂ ਮੇਰਾ ਬਹੁਤ ਟਾਈਮ ਦੀ ਬਰਬਾਦੀ ਹੋ ਰਹੀ ਹੈ ਮੈਂ ਜ਼ਰੂਰੀ ਜਾਣਾ ਸੀਗਾ ਇਸ ਲਈ ਮੈਨੂੰ ਕੋਈ ਨਾ ਕੋਈ ਹਿੱਲਾ ਕਰਕੇ ਦਿੱਤਾ ਜਾਵੇ